ਪਿਛਲੇ ਸਾਲਾਂ ਤੋਂ ਮੋਹਾਲੀ ਜ਼ਿਲ੍ਹੇ ਦਾ ਕਾਫ਼ੀ ਕਾਫ਼ੀ ਵਿਸਥਾਰ ਹੋਇਆ ਹੈ ਅਤੇ ਬਹੁਤ ਸਾਰੀਆਂ ਦੇਖਣ ਯੋਗ ਥਾਵਾਂ ਬਣੀਆਂ ਹਨ ਜਿਵੇਂ ਕਿ ਚੱਪੜਚਿੜੀ ਬੰਦਾ ਬਹਾਦਰ ਦੀ ਯਾਦਗਾਰ ਫ਼ਤਿਹ ਬੁਰਜ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਜਿੱਥੇ ਜਾ ਕੇ ਲੋਕੀਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹਨ ਤੇ ਛੱਤਬੀੜ ਚਿੜੀਆ ਘਰ ਵੀ ਇੱਕ ਬਹੁਤ ਵਧੀਆ ਦੇਖਣ ਯੋਗ ਥਾਂ ਹੈ ਮੋਹਾਲੀ ਦੇ ਸ ਸਾਰੇ ਤਕਰੀਬਨ ਸਕੂਲ ਤੇ ਲੋਕੀ ਦੇਖਣ ਜਾਂਦੇ ਹਨ ਤੇ ਧਾਰਮਿਕ ਸਥਾਨਾਂ ਦਾ ਵੀ ਬਹੁਤ ਵਧੀਆ ਤਰੀਕੇ ਨਾਲ ਵਿਸਥਾਰ ਹੋਇਆ ਹੈ ਜਿਵੇਂ ਗੁਰਦੁਆਰੇ ਮੰਦਰ ਤੇ ਉਹਨਾਂ ਦਾ ਪਹਿਲਾਂ ਜਿਵੇਂ ਸੀਗਾ ਉਹਨਾਂ ਦੇ ਇਮਾਰਤਾਂ ਤੇ ਉੱਥੇ ਕਾਫ਼ੀ ਸਹੂਲਤਾਂ ਹੁਣ ਹੋਰ ਵਧੀਆ ਤਰੀਕੇ ਨਾਲ ਬਣ ਗਈਆਂ ਹਨ ਤੇ ਜਿਹੜੇ ਪਾਰਕ ਵਗੈਰਾ ਵੀ ਬਹੁਤ ਵਧੀਆ ਬਣ ਗਏ ਹਨ ਤੇ ਇੱਥੇ ਜਿਹੜੀ ਲੋਕਾਂ ਦਾ ਹੈਗਾ ਮੇਨ ਜਿੰਮ ਦਾ ਵੀ ਇੱਥੇ ਕਾਫ਼ੀ ਲੋਕਾਂ ਨੇ ਜਿੰਮ ਕੀਤੀ ਹੋਈ ਹੈ ਜਿਨ ਜਿਹਦੇ ਨਾਲ ਰੁਜ਼ਗਾਰ ਵੀ ਵਧਿਆ ਤੇ ਲੋਕਾਂ ਦੀ ਸਿਹਤ ਵੱਲ ਵੀ ਬਹੁਤ ਵਧੀਆ ਧਿਆਨ ਦੇ ਹੋ ਰਿਹਾ ਹੈ ਜਿਹੜੇ ਬੱਚੇ ਨਸ਼ੇ ਨੁਸ਼ੇ ਕਰਦੇ ਹਨ ਉਹ ਜਿੰਮ 'ਚ ਜਾ ਕੇ ਆਪਣੀ ਮਤਲਬ ਸਿਹਤ ਵਧੀਆ ਰੱਖਦੇ ਹਨ ਤੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਔਰਤਾਂ ਲਈ ਵੂਮਨ ਸੈੱਲ ਖੁੱਲ੍ਹ ਗਏ ਹਨ ਜਿੰਨਾਂ ਕਾਰਨ ਉਹਨਾਂ ਨੂੰ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਜਾਗਰੂਕਤਾ ਮਿਲਦੀ ਹੈ ਤੇ ਆਪਣੇ ਲੋੜ ਪੈਣ ਤੇ ਉਹ ਆਪਣੀ ਕਾਨੂੰਨੀ ਸਲਾਹ ਤੇ ਸਹਾਇਤਾ ਵੀ ਲੈ ਸਕਦੀਆਂ ਹਨ